ਹਾਂਜੀ ਯੋਗਾ ਸਿੱਖਣ ਲਈ ਮੈਂ ਚੈਨਲਾਂ ਨੂੰ ਦੇਖਦੀ ਰਹਿੰਦੀ ਹਾਂ ਅਤੇ ਕਈ ਚੈਨਲ ਨੇ ਕਈ ਜਿਹੜੇ ਯੋਗਾ ਸਿਖਾਉਣ ਵਾਲੇ ਨੇ ਉਹ ਬਹੁਤ ਵਧੀਆ ਯੋਗਾ ਦੀ ਕੋਚਿੰਗ ਟੀ ਵੀ 'ਤੇ ਦੇ ਰਹੇ ਨੇ ਸਭ ਤੋਂ ਪਹਿਲਾਂ ਤਾਂ ਬਾਬਾ ਰਾਮਦੇਵ ਵੀ ਨੇ ਉਹਨਾਂ ਨੇ ਯੋਗਾ ਨੂੰ ਸਾਡੇ ਇੰਡੀਆ 'ਚ ਤਾਂ ਕੀ ਪੂਰੇ ਸੰਸਾਰ ਵਿੱਚ ਫੇਮਸ ਕੀਤਾ ਅਤੇ ਉਹਨਾਂ ਦੇ ਕਰਕੇ ਹੀ ਕਾਫੀ ਲੋਕ ਯੋਗਾ ਨਾਲ ਜੁੜ ਚੁੱਕੇ ਨੇ ਅੱਜ ਯੋਗਾ ਹੈ ਹੀ ਇਸ ਤਰ੍ਹਾਂ ਕਿ ਇਹਨੇ ਪੂਰੇ ਸੰਸਾਰ ਨੂੰ ਇੱਕ ਤੰਦਰੁਸਤੀ ਵੱਲ ਜਾਣ ਦਾ ਨਵਾਂ ਰਸਤਾ ਦਿਖਾਇਆ ਅਤੇ ਯੋਗਾ ਸਿੱਖਣ ਵੇਲੇ ਸਭ ਦੌਰਾਨ ਲੋਕਾਂ ਨੂੰ ਕਿਹੜੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿ ਸਭ ਤੋਂ ਪਹਿਲਾਂ ਲੋਕ ਸ ਇਹ ਸਵੇਰੇ ਖਾਲ੍ਹੀ ਪੇਟ ਕਰਨੀ ਚਾਹੀਦੀ ਆ ਲੋਕ ਇਹ ਨਹੀਂ ਫੋਲੋ ਕਰ ਪਾਉਂਦੇ ਜਿਹੜਾ ਟਾਈਮ ਟੇਬਲ ਆ ਰੂਟੀਨ ਹੈ ਸਹੀ ਇਹਨੂੰ ਫੋਲੋ ਕਰਨਾ ਬਹੁਤ ਜ਼ਰੂਰੀ ਹੈ ਜੇ ਤੁਸੀਂ ਯੋਗਾ ਕਰ ਰਹੇ ਹੋ ਤਾਂ ਯੋਗਾ ਦੇ ਨਿਯਮ ਬਹੁਤ ਜ਼ਿਆਦਾ ਸਖ਼ਤ ਹਨ ਥੋੜ੍ਹੇ ਜਿਹੇ ਨਹੀਂ ਕਿਉਕਿ ਸਵੇਰੇ ਕਰਨਾ ਇਕਾਂਤ ਵਾਲੀ ਥਾਂ 'ਚ ਕਰਨਾ ਅਤੇ ਪੂਰੇ ਨਿਯਮ ਨਾਲ ਕਰਨਾ ਇਹ ਜ਼ਿਆਦਾ ਜ਼ਰੂਰੀ ਹੈ ਕਿ ਪਰ ਅੱਜ ਕੱਲ੍ਹ ਲੋਕ ਕਰਦੇ ਜਦੋਂ ਮਰਜ਼ੀ ਉੱਠ ਕੇ ਕੁਛ ਖਾ ਪੀ ਕੇ ਕਰਨਾ ਸਟਾਰਟ ਕਰ ਦਿੰਦੇ ਨੇ ਫਿਰ ਕਹਿੰਦੇ ਸਾਨੂੰ ਇਸਦੇ ਗਲਤ ਸਿੱਟੇ ਨਿਕਲੇ ਨੇ ਬਸ ਉਹ ਗਲਤ ਸਿੱਟਿਆਂ ਦਾ ਕਾਰਨ ਇਹੀ ਹੈ ਕਿ ਇਹਨੂੰ ਕਰਨ ਦਾ ਤਰੀਕਾ ਗਲਤ ਹੋ ਜਾਂਦਾ ਅਸੀਂ ਕਰਨਾ ਤੰਦਰੁਸਤੀ ਵੱਲ ਜਾਣਾ ਤਾਂ ਚਾਹੁੰਦੇ ਹਾਂ ਪਰ ਓਨਾ ਅਸੀਂ ਉਹ ਚੀਜ਼ ਨੂੰ ਸਿਸਟਮੈਟਿਕਲੀ ਹੈਂਡਲ ਨਹੀਂ ਕਰਦੇ ਹੈਗੇ ਜਿੰਨਾ ਸਾਨੂੰ ਕਰਨਾ ਚਾਹੀਦਾ ਸਾਨੂੰ ਅੱਧਾ ਕਹਿੰਦੇ ਨੇ ਜਿਹੜਾ ਗਿਆਨ ਹੈ ਉਹ ਬਹੁਤ ਮਾੜਾ ਹੁੰਦਾ ਹੈ ਪੂਰਾ ਗਿਆਨ ਲੈਣਾ ਚਾਹੀਦਾ ਜੇ ਅਸੀਂ ਕਿਸੇ ਵੀ ਚੀਜ਼ ਨੂੰ ਕਰਦੇ ਹਾਂ ਤਾਂ ਯੋਗਾ ਲਈ ਪੂਰੇ ਨਿਯਮ ਜਾਣਨਾ ਯੋਗਾ ਦਾ ਬਹੁਤ ਜ਼ਰੂਰੀ ਹੈ ਜੇ ਤੁਸੀਂ ਯੋਗਾ ਕਰਨਾ ਚਾਹੁੰਦੇ ਹੋ ਧੰਨਵਾਦ